ਐਮਰਜੈਂਸੀ ਸੇਵਾਵਾਂ ਨੂੰ ਡਾਇਲ ਕਰੋ ਹੈਲੋ ਮੈਨੂੰ ਤੁਰੰਤ ਮੈਡੀਕਲ ਸਹਾਇਤਾ ਦੀ ਜ਼ਰੂਰਤ ਹੈ ਮੇਰੇ ਦੋਸਤ ਨੂੰ ਐਲਰਜੀ ਪਰਕੀਆ ਹੋ ਗਈ ਹੈ ਐਲਰਜੀ ਪਰਕੀਆ ਦੇ ਲੱਛਣ ਉਸਦੇ ਸਰੀਰ ਉੱਤੇ ਦਾਗ ਹਨ ਚਮੜੀ ਉੱਤੇ ਖੁਜਲੀ ਹੋ ਰਹੀ ਹੈ ਅਤੇ ਸਾਹ ਲੈਣ 'ਚ ਪਰੇਸ਼ਾਨੀ ਹਨ ਉਹਨਾਂ ਦੀ ਸਾਂਸ ਦੀ ਦਰ ਤੇਜ਼ ਹੋ ਗਈ ਹੈ ਅਤੇ ਉਹ ਬੇਹੋਸ਼ ਹੋ ਰਹੇ ਹਨ ਜਾਣੀ ਪਹਿਚਾਣੀ ਐਲਰਜੀ ਉਹਨਾਂ ਕੋਲ ਪਹਿਲਾਂ ਵੀ ਕੁਝ ਐਲਰਜੀਆਂ ਦੇ ਕੇਸ ਸਾਹਮਣੇ ਆਏ ਹਨ ਜਿਵੇਂ ਕਿ ਖਾਣ ਦੀਆਂ ਚੀਜ਼ਾਂ ਨਾ ਅਭਿਸ਼ੇਦ ਦਵਾਈ ਦੇ ਪ੍ਰਤੀ ਸੁਸ਼ੀਲਤਾ ਵਿਅਕਤੀ ਦੀ ਮੌਜੂਦਾ ਸਥਿਤੀ ਉਹ ਬਹੁਤ ਤੇਜ਼ੀ ਨਾਲ ਬੇਹੋਸ਼ ਹੋ ਰਹੇ ਹਨ ਉੱਥੇ ਉਹਨਾਂ ਦੀ ਸਾਂਸ ਲੈਣ ਦੀ ਦਰ ਬਹੁ ਤੇਜ਼ ਹੋ ਗਈ ਹੈ ਉਹਨਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਦੀ ਜ਼ਰੁਰਤ ਹੈ ਕਿਰਪਾ ਕਰਕੇ ਤੁਰੰਤ ਸਹਾਇਤਾ ਭੇਜੋ